ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਅਸੀਂ ਪੰਜਾਬ ਵਿੱਚ ਹੀ ਜੰਮੇ ਪਲੇ ਹਾਂ ਪੰਜਾਬ ਵਿੱਚ ਦਾ ਮਾਹੌਲ ਬਹੁਤ ਵਧੀਆ ਹੈ ਇੱਥੇ ਕਈ ਥਾਵਾਂ ਘੁੰਮਣ ਵਾਲੀਆਂ ਹਨ ਜਿਵੇਂ ਅੰਮ੍ਰਿਤਸਰ ਅਨੰਦਪੁਰ ਸਾਹਿਬ ਜਾ ਕੇ ਬਹੁਤ ਨਜ਼ਾਰਾ ਆਉਂਦਾ ਹੈ ਅਸੀਂ ਛੁੱਟੀਆਂ ਵਿੱਚ ਅਕਸਰ ਹੀ ਘੁੰਮਣ ਜਾਂਦੇ ਰਹਿੰਦੇ ਹਾਂ ਉੱਥੇ ਜਾ ਕੇ ਸਾਨੂੰ ਸ਼ਾਂਤੀ ਮਿਲਦੀ ਹੈ ਅਤੇ ਇੱਥੋਂ ਬਹੁਤ ਸਾਰੀਆਂ ਪਰੰਪਰਾਵਾਂ ਹਨ ਮੇ ਇੱਥੇ ਮੇਲੇ ਵੀ ਲੱਗਦੇ ਹਨ ਜੇ ਜਾ ਕੇ ਮੇਲਿਆਂ ਵਿੱਚ ਜਾ ਕੇ ਬਹੁਤ ਮਜ਼ਾ ਆਉਂਦਾ ਹੈ ਜਿਵੇਂ ਲੋਹੜੀ ਦਾ ਮਾਘੀ ਦਾ ਮੇਲਾ ਵਿਸਾਖੀ ਦਾ ਮੇਲਾ ਲੋਕ ਆਮ ਜਾਂਦੇ ਹਨ ਅਤੇ ਇੱਥੋਂ ਦਾ ਮਾਹੌਲ ਵੀ ਬਹੁਤ ਵਧੀਆ ਹੈ ਲੋਕ ਇਕੱਠੇ ਮਿਲ ਜੁਲ ਕੇ ਰਹਿੰਦੇ ਹਨ ਅਤੇ ਇਕੱਠੇ ਮਿਲ ਕੇ ਬਹਿੰਦੇ ਹਨ ਸਾਰੇ ਘਰਾਂ ਵਿੱਚ ਖੁਸ਼ ਰਹਿੰਦੇ ਹਨ ਅਤੇ ਸਾਰਿਆਂ ਦੀਆਂ ਜੁਆਇੰਟ ਫੈਮਲੀਆਂ ਹਨ